ਪਿੱਠ ਦਰਦ ਪਿੱਠ ਦਰਦ ਦੇ ਘਰੇਲੂ ਨੁਸਖੇ ਗਰਮ ਕਰਕੇ ਪਾਣੀ ਦੀ ਬੋਤਲ ਪਿੱਠ 'ਤੇ ਰੱਖਣੀ ਗਰਮ ਕਰਕੇ ਰੇਤਾ ਲਾਉਣਾ ਅਤੇ ਜੈਫਲ ਖਾਣਾ ਗਰਮ ਚੀਜ਼ਾਂ ਖਾਣੀਆਂ ਅਤੇ ਸਾਡੇ ਪਿੰਡ ਵਿੱਚ ਬਹੁਤ ਸਾਰੇ ਇਹੀ ਚੀਜ਼ਾਂ ਲੋਕ ਕਰਦੇ ਹਨ ਜੈਫਲ ਗਰਮ ਚੀਜ਼ਾਂ ਖਾਂਦੇ ਹਨ ਅਤੇ ਪਾਣੀ ਗਰਮ ਕਰਕੇ ਪਿੱਠ ਦੀ ਮਾਲਿਸ਼ ਕਰਨੀ